ਗੁਰੂ ਗ੍ਰੰਥ ਸਾਹਿਬ ਜੀ ਜੇ ਜੋ ਮਹੱਤਵ ਹੈ ਇਹ ਗੁਰਦੁਆਰੇ ਵਿੱਚ ਜੋ ਕਰਦੇ ਹਨ ਜੋ ਭੈਣ ਭਰਾ ਜੋ ਵੀ ਲੋਕ ਕਿਸੇ ਧਰਮ ਦੇ ਹੈ ਇਹ ਗੁਰਦੁਆਰੇ ਆ ਕੇ ਮੱਥਾ ਟੇਕਦੇ ਹੈ ਬੜਾ ਸਨਮਾਨਿਤ ਕੀਤਾ ਜਾਂਦਾ ਹੈ ਪਰ ਕੀ ਕਿਵੇਂ ਮੁਸਲਮਾਨ ਕੁਰਾਨ ਪੜ੍ਹਦੇ ਹਨ ਅਸੀਂ ਵੇਖ ਜੋ ਕਿ ਆਪੋ ਆਪਦੇ ਕੁਰਾਨ ਪੜ੍ਹਦੇ ਆ ਜਿਵੇਂ ਈਸ਼ਾ ਮਸੀਹ ਦੇ ਅਲੱਗ ਅਲੱਗ ਨੇ ਮੰਦਰ ਪੰਡਤ ਹੈ ਮੰਦਰਾਂ ਨੂੰ ਹੀ ਪੂਜਦੇ ਹਨ ਜੋ ਕਿ ਧਰਮ ਤਾਂ ਇੱਕ ਹੀ ਹੈ ਜੇਕਰ ਆਪਾਂ ਹੁਣ ਗੁਰਦੁਆਰੇ ਜਾਵਾਂਗੇ ਮੱਥਾ ਟੇਕਾਂਗੇ ਉਹਨਾਂ ਨੂੰ ਵੀ ਉਹ ਹੀ ਪ੍ਰਸ਼ਾਦ ਦਿੱਤਾ ਜਾਂਦਾ ਉਹ ਹੀ ਲੰਗਰ 'ਚ ਬਹਾਇਆ ਜਾਂਦਾ ਲੈਣਾ ਵਿੱਚ ਬਹਾ ਕੇ ਉਹਨਾਂ ਨੂੰ ਸਾਰਾ ਸਨਮਾਨਿਤ ਕੀਤਾ ਜਾਂਦਾ ਹੈ ਜੋ ਕਿ ਇਹ ਦੀ ਗ੍ਰੰਥ ਪੜ੍ਹਦੇ ਨੇ ਜੇਕਰ ਆਪਾਂ ਦੇਖਿਆ ਜਾਵੇ ਮੰਦਰ 'ਚ ਜਾਂਦੇ ਹਾਂ ਉੱਥੇ ਭੇਟਾਂ ਬੋਲੀਆਂ ਜਾਂਦੀਆਂ ਨੇ ਕੀਰਤਨ ਕੀਤਾ ਜਾਂਦਾ ਹੈ ਪ੍ਰਸ਼ਾਦ ਵੰਡਿਆ ਜਾਂਦਾ ਹੈ ਹੈ ਸਾਰਾ ਕੁਝ ਇੱਕ ਹੀ ਜੇਕਰ ਮੁਸਲਮਾਨ ਵੰਨੀ ਜਾਈਏ ਇਹ ਆਪਣੀ ਮਾਸੀਤ 'ਚ ਬੈਠੇ ਉਹਦਾ ਕੁਰਾਨ ਪੜ੍ਹਦੇ ਹਨ ਆਪਣੀ ਕਲਾਮ ਪੜ੍ਹਦੇ ਨੇ ਇਹਨਾਂ ਦਾ ਉਹ ਹੁੰਦਾ ਹੈ ਵਤੀਰਾ ਪਰ ਜੋ ਕਿ ਇੱਕ ਦੇਖਿਆ ਜਾਵੇ ਪਰਮਾਤਮਾ ਸਭ ਦਾ ਇੱਕ ਹੀ ਹੈ ਜੋ ਕੋਈ ਬਗਲ ਨੂੰ ਮੰਨਦਾ ਹੈ ਚਾਹੇ ਗ੍ਰੰਥ ਨੂੰ ਮੰਨਦਾ ਹੈ ਇਹ ਜੋ ਸਭ ਚੀਜ਼ਾਂ ਨੇ ਆਪਣੀਆਂ ਹੀ ਬਣਾਈਆਂ ਪਰਮਾਤਮਾ ਸਭ ਏਕ ਹੈ ਨੇਕ ਹੈ ਰੂਪ ਅਨੇਕ ਹੈ ਪਰਮਾਤਮਾ ਏਕ ਹੈ ਇਸ ਕਰਕੇ ਗੁਰਦੁਆਰੇ ਆ ਕੇ ਸਤਿ ਸ਼੍ਰੀ ਅਕਾਲ ਬੋਲੀ ਜਾਂਦੀ ਹੈ ਆਪਾਂ ਸਤਿ ਸ਼੍ਰੀ ਅਕਾਲ ਬੋਲ ਦਿੰਦੇ ਆ ਮੰਦਰ ਜਾਂਦੇ ਹਾਂ ਆਪਾਂ ਜੈਕਾਰਾ ਲਗਾ ਦਿੰਦੇ ਹਾਂ ਜੇਕਰ ਮੁਸਲਮਾਨਾਂ ਦਾ ਦੇਖਿਆ ਜਾਵੇ ਮੁਸਲਮਾਨ ਆਪਣੀ ਆਵਾਜ਼ ਵਿੱਚ ਉਹ ਜੋ ਬੋਲਦੇ ਨੇ ਉਹ ਬੋਲ ਲੈਂਦੇ ਨੇ ਬਬਲ ਵਾਲੇ ਨੇ ਜੋ ਉਹ ਆਪਣੇ 'ਚ ਬੋਲ ਲੈਂਦੇ ਨੇ ਜੇ ਇਹ ਜੋ ਵੀ ਪਰਮਾਤਮਾ ਜਾਂਦੇ ਹਾਂ ਪਰਮਾਤਮਾ ਏਕ ਹੈ ਪਰ ਇਹ ਆਪਣੇ ਜੋ ਬਣਾਏ ਹੋਏ ਨੇ ਇਹ ਆਪਾਂ ਬਣਾਏ ਨੇ ਪਰ ਉੱਥੋਂ ਜੋ ਹੈ ਵੀ ਪਰਮਾਤਮਾ ਏਕ ਹੈ ਜਿੱਥੇ ਵੀ ਆਪਾਂ ਜਾਂਦੇ ਹਾਂ ਗੁਰਦੁਆਰੇ ਮੰਦਰ ਮਸੀਤ ਸਭ ਹੀ ਏਕ ਹੈ ਇਸ ਕਰ ਇੱਕ ਸਭ ਨੂੰ ਇਕ ਮੰਨੋ ਇੱਕ ਨਜ਼ਰ ਨਾਲ ਦੇਖਣ ਕਰਕੇ ਸਾਰਿਆਂ ਦਾ ਹੁੰਦਾ ਗ੍ਰੰਥ ਚੋਂ ਹੀ ਸੋ ਜੋ ਚੀਜ਼ਾਂ ਨੇ ਗ੍ਰੰਥ ਚੋਂ ਹੀ ਨੇ ਇੱਕ ਚੀਜ਼ ਹੈ ਵਾਹਿਗੁਰੂ ਇੱਕ ਹੈ ਐਸਾ ਗੋਡ ਇੱਕ ਹੈ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਅਲੱਗ ਅਲੱਗ ਨਾਂ ਲੈ ਕੇ ਬੋਲਦੇ ਹਾਂ ਪਰ ਪਰਮਾਤਮਾ ਇੱਕ ਹੀ ਹੈ ਜਿਸਨੂੰ ਆਪਾਂ ਮੰਨਦੇ ਹਾਂ ਮੱਥਾ ਟੇਕਦੇ ਹਾਂ ਜਾਂ ਬੋਲਦੇ ਹਾਂ ਬਸ ਇੱਕ ਬੋਲਣ ਦਾ ਹੀ ਜ਼ਰੀਆਂ ਹੋਰ ਹੈ ਦੇਖਣ ਦਾ ਜ਼ਰੀਆਂ ਹੋਰ ਹੈ ਅਤੇ ਸਤਿਗੁਰ ਪਰਮਾਤਮਾ ਵਾਹਿਗੁਰੂ ਗੌਡ ਇਹ ਜੋ ਵੀ ਹੈ ਇੱਕ ਹੈ ਇਹ ਬੰਦਿਆਂ ਨੇ ਬਣਾਏ ਨੇ ਇਨਸਾਨ ਬਣਾਉਣ ਵਾਲਾ ਹੈ ਪਰਮਾਤਮਾ ਸਭ ਨੂੰ ਇੱਕ ਹੀ ਨਜ਼ਰ ਨਾਲ ਦੇਖਦਾ ਹੈ ਅਤੇ ਪਰਮਾਤਮਾ ਹੈ ਵੀ ਇੱਕ ਸੀ ਵੀ ਇੱਕ ਹੈਗਾ ਵੀ ਇੱਕ ਹੈ ਅਤੇ ਰਹੂਗਾ ਵੀ ਇੱਕ ਦੇਖਣ ਦੇ ਨਜ਼ਰੀਏ ਅਲੱਗ ਅਲੱਗ ਨੇ ਪਰਮਾਤਮਾ ਇੱਕ ਹੀ ਹੈ ਇਹ ਜੋ ਇਨਸਾਨ ਬਣਾਉਂਦਾ ਇਨਸਾਨ ਦੇ ਨ ਦੇਖਣ ਦੇ ਨਜ਼ਰੀਏ ਅਲੱਗ ਹੀ ਨੇ ਅਤੇ ਅਲੱਗ ਨੇ ਅਤੇ ਪਰਮਾਤਮਾ ਇੱਕ ਹੀ ਹੈ ਅਤੇ ਇੱਕ ਹੀ ਰਹੇਗਾ ਦੇਖਣ ਦੇ ਨਜ਼ਰੀਏ ਅਲੱਗ ਨੇ ਔਰ ਕੋਈ ਨਹੀਂ ਪਰਮਾਤਮਾ ਇੱਕ ਹੈ ਅਤੇ ਇੱਕ ਹੀ ਰਹੇਗਾ